ਅਸੀਂ ਦੇਖ ਸਕਦੇ ਹਨ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਰੋਗ ਆ ਕੇ ਚਿੰਬੜ ਹੀ ਲੈਂਦਾ ਹੈ ਅਤੇ ਜੇਕਰ ਸਾਨੂੰ ਵੀ ਪਤਾ ਹੈ ਅਸੀਂ ਸਾਡਾ ਸਰੀਰ ਚੁਸਤ ਰਹੇਗਾ ਤਾਂ ਸਾਨੂੰ ਕੋਈ ਵੀ ਰੋਗ ਨਹੀਂ ਲੱਗ ਸਕਦਾ ਜਿਵੇਂ ਕਿ ਖੇਡਾਂ ਹੈ ਖੇਡ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਲਾਭ ਪਹੁੰਚਾਉਂਦੀ ਹੈ ਜੇਕਰ ਅਸੀਂ ਕਿਸੇ ਵੀ ਖੇਡ ਵਿੱਚ ਆਪਣੀ ਰੁਚੀ ਦਿਖਾਵਾਂਗੇ ਅਤੇ ਨਾਲ਼ ਹੀ ਨਾਲ਼ ਉਸਨੂੰ ਰੋਜ਼ ਪ੍ਰੈਕਟਿਸ ਕਰਾਂਗੇ ਅਤੇ ਅਸੀਂ ਉਸ ਵਿੱਚ ਆਪਣਾ ਫਿਊਚਰ ਵੀ ਬਣਾ ਸਕਦੇ ਹਨ ਅਤੇ ਨਾਲ਼ ਹੀ ਨਾਲ ਸਾਡੇ ਜੀਵਨ ਅਤੇ ਸਵਸਥ ਨੂੰ ਬਿਲਕੁਲ ਠੀਕ ਰੱਖ ਸਕਦੇ ਹਨ ਜਿਹੜੀ ਖੇਡ ਹੁੰਦੀ ਹੈ ਉਹ ਸਾਡਾ ਮਾਨਸਿਕ ਵਿਕਾਸ ਵੀ ਕਰਦੀ ਹੈ ਜਿਵੇਂ ਕਿ ਮਾਇੰਡ 'ਚ ਬਹੁਤ ਜ਼ਿਆਦਾ ਸਟ੍ਰੈਸ ਵਗੈਰਾ ਰਹਿੰਦਾ ਹੈ ਅਸੀਂ ਖੇਡ ਰਾਹੀਂ ਆਪਣਾ ਸਟ੍ਰੈਸ ਘਟਾ ਸਕਦੇ ਹਨ ਜਿਵੇਂ ਕਿ ਕੋਈ ਹੈ ਜਿਸ ਦੇ ਮਨ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਹੈ ਅਤੇ ਉਹ ਰੋਜ਼ ਮੈਦਾਨ ਵਿੱਚ ਖੇਡਣ ਜਾਂਦਾ ਹੈ ਬਾਹਰ ਦੀ ਖੁੱਲ੍ਹੀ ਹਵਾ ਅਤੇ ਅਤੇ ਪਕਸ਼ੀ ਵਗੈਰਾ ਦੀ ਚਿਰਚਿਰ ਆਵਾਜ਼ ਸੁਣ ਕੇ ਸਾਡਾ ਦਿਮਾਗ ਬਹੁਤ ਠੰਡਾ ਹੁੰਦਾ ਹੈ ਅਤੇ ਮਾਇੰਡ ਵਗੈਰਾ ਸਭ ਕੁਝ ਸ਼ਾਂਤ ਰਹਿੰਦਾ ਹੈ ਉਸ ਕਰਕੇ ਸਾਡਾ ਸਟ੍ਰੈਸ ਵੀ ਘੱਟ ਜਾਂਦਾ ਹੈ